ਪੰਜਾਬ ਲੋਕ ਗੀਤਾਂ ਦੀ ਧਰਤੀ ਹੈ ਇੱਥੇ ਦਾ ਹਰ ਇੱਕ ਵਾਸੀ ਗੀਤਾਂ ਵਿੱਚ ਜਨਮ ਲੈਂਦਾ ਹੈ ਗੀਤਾਂ ਵਿੱਚ ਬਚਪਨ ਗੁਜਾਰਦਾ ਹੈ ਗੀਤਾਂ ਵਿੱਚ ਪਲ ਕੇ ਜਵਾਨ ਹੁੰਦਾ ਗੀਤਾਂ ਵਿੱਚ ਵਿਆਹ ਹੁੰਦਾ ਔਰ ਗੀਤਾਂ ਵਿੱਚ ਹੀ ਜੀਵਨ ਗੁਜ਼ਾਰ ਕੇ ਗੀਤਾਂ ਵਿੱਚ ਹੀ ਮਰ ਜਾਂਦਾ ਹੈ ਇੰਝ ਲੋਕ ਗੀਤਾ ਦਾ ਸੰਬੰਧ ਪੰਜਾਬ ਦੇ ਪੂਰੇ ਸੱਭਿਆਚਾਰ ਜੀਵਨ ਨਾਲ ਹੈ ਲੋਕ ਗੀਤ ਤਾਂ ਕਿਸੇ ਦੇਸ਼ ਦੇ ਸੱਭਿਆਚਾਰ ਦਾ ਸ਼ੀਸ਼ਾ ਹੁੰਦਾ ਹੈ ਲਬ ਬਾਵਾ ਲੋਕ ਗੀਤ ਦੀ ਰਚਨਾ ਕੋਈ ਵਿਸ਼ੇਸ਼ ਕਵੀ ਜਾਂ ਕਿਸੀ ਵਿਸ਼ੇਸ਼ ਕਲਾਕਾਰ ਨਹੀਂ ਕਰ ਕਰਦਾ ਸਗੋਂ ਇਹ ਤਾਂ ਲੋਕ ਦਿਲਾਂ ਵਿੱਚ ਆਪ ਮੁਹਾਰੇ ਫੁੱਟਦੇ ਹਨ ਲੋਕ ਗੀਤ ਮਨੁੱਖੀ ਮਨ ਵਿੱਚ ਪੈਦਾ ਹੋਣ ਵਾਲੀ ਸਧਰਾਂ ਰੀਝਾਂ ਚੌਂਕੀਆਂ ਅਤੇ ਚਾਵਾਂ ਦਾ ਕਾਵਮਈ ਪ੍ਰਗਟਾਵਾ ਹੁੰਦਾ ਹੈ ਸਧਾਰਨ ਲੋਕ ਗੀਤ ਦੇ ਦਿਲਾਂ ਦੇ ਭਾਵ ਲੋਕ ਗੀਤਾਂ ਦੇ ਰੂਪ ਬਣ ਕੇ ਆਪ ਮੁਹਾਰੇ ਹੀ ਮਨ ਵਿੱਚੋਂ ਵਹਿ ਜਾਂਦੇ ਹਨ ਲੋਕ ਬਾਵਾ ਲੋਕ ਗੀਤ ਦੀ ਮੁੱਖ ਰਚਨਾ ਗੁਰਮੀਤ ਬਾਵਾ ਜੀ ਦੇ ਦੁਆਰਾ ਕੀਤੀ ਗਈ ਹੈ ਉਹਨਾਂ ਦੀ ਸਧਰਾਂ ਉਹ ਪੁੱਤਰ ਸੱਤ ਵੀ ਹੋਣ ਸੰਭਾਲਣ ਦੇ ਵੇ ਬਬੁਲਾ ਪੁੱਤਰ ਸੱਤ ਵੀ ਹੋਣ ਸਮਾ ਲਾਉਂਦੇ ਹਾਏ ਪੁੱਤਰ ਸੱਤ ਵੀ ਹੋਣ ਸਮਾਂ ਲਾਉਂਦੇ ਵੇ ਧੀ ਕਰਨਾ ਇੱਕ ਸਮਾਂ ਲਾਉਂਦੇ ਜਿਹੜੀ ਤੁਰਨ ਵੇਲੇ ਘਰੋਂ ਗਈ ਰੋਂਦੀ ਉਹ